ਜਾਂ ਪ੍ਰਾਈਵੇਟ ਹਸਪਤਾਲ ਹਨ ਉੱਥੋਂ ਦੇ ਉੱਥੋਂ ਦੀਆਂ ਮਸ਼ੀਨਾਂ ਜਾਂ ਟੂਲਸ ਸਿਟੀ ਸਕੈਨ ਅਕਸਰੇ ਮਸ਼ੀਨਸ ਮੌਜੂਦ ਹਨ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਟੈਸਟ ਵਗੈਰਾ ਕੀਤੇ ਜਾਂਦੇ ਹਨ ਅਤੇ ਜਿਵੇਂ ਕਿ ਘੁੱਦਾ ਛੋਟਾ ਸ਼ਹਿਰ ਕਰਕੇ ਉੱਥੋਂ ਦਾ ਜਿਹੜਾ ਸਰਕਾਰੀ ਹਸਪਤਾਲ ਆ ਉੱਥੇ ਇਹ ਮਸ਼ੀਨਾਂ ਵਗੈਰਾ ਘੱਟ ਹੁੰਦੀਆਂ ਹਨ ਜਿੰਨਾਂ ਕਰਕੇ ਅਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਕਿ ਟੈਸਟ ਵਗੈਰਾ ਦਾ ਸਿਟੀ ਸਕੈਨ ਐਕਸਰੇ ਕਰਵਾਉਣ ਵਿੱਚ ਪ੍ਰੋਬਲਮ ਆਉਂਦੀ ਆ ਅਤੇ ਜਿੰਨਾ ਉੱਥੋਂ ਦੇ ਲੋਕਾਂ ਨੂੰ ਬਹੁਤ ਹੀ ਸਮੱਸਿਆ ਹੁੰਦੀ ਆ ਅਤੇ ਉਹਨਾਂ ਨੂੰ ਬ ਬਠਿੰਡੇ ਜਾ ਕੇ ਜਾਂ ਹੋਰ ਕੋ ਹੋਰ ਹਸਪਤਾਲਾਂ ਵਿੱਚ ਜਾ ਕੇ ਐਮਰਜੈਂਸੀ ਐਮਰਜੈਂਸੀ ਟੈਸਟ ਜਾਂ ਐਕਸਰੇ ਵਗੈਰਾ ਕਰਵਾਉਣੇ ਪੈਂਦੇ ਆ ਪਰ ਕਈ ਹਸਪਤਾਲਾਂ ਵਿੱਚ ਸਿਟੀ ਸਕੈਨ ਜਾਂ ਹੋਰ ਵੀ ਟੈਸਟ ਬਹੁਤ ਹੀ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਹਨ ਅਤੇ ਜਿਹੜੇ ਕਿ ਛੋਟੇ ਮੋਟੇ ਟੈਸਟ ਜਾਂ ਸਿਟੀ ਸਕੈਨ ਜਾਂ ਬਲੱਡ ਪ੍ਰੈਸ਼ਰ ਦੀ ਜਾਂਚ ਕਰਨ ਲਈ ਕੀਤੇ ਜਾ ਹੋਰ ਵੀ ਜਾਂ ਮਾੜੇ ਮੋਟੇ ਪਿੰਡਾਂ ਦੀਆਂ ਲਬੋਟਰੀਆਂ ਵਿੱਚ ਹੀ ਜਾ ਕੇ ਕਰਾ ਸਕਦੇ ਹਾਂ ਸਾਨੂੰ ਹਸਪਤਾਲ ਜਾ ਕੇ ਜਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਪਿੰਡਾਂ ਦੀਆਂ ਲਬੋਰਟਰੀਆਂ ਵਿੱਚ ਵੀ ਇਹ ਟੈਸਟ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਹਨ ਅਤੇ ਮੈਂ ਚਾਹੁੰਦਾ ਕਿ ਜਿਹੜੇ ਵੀ ਹਸਪਤਾਲਾਂ 'ਚ ਮਤਲਬ ਕਿ ਸਿਟੀ ਸਕੈਨ ਜਾਂ ਐਕਸਰੇ ਵਗੈਰਾ ਦੀ ਮਸ਼ੀਨਾਂ ਨਹੀਂ ਹਨ ਉੱਥੇ ਸਰਕਾਰ ਉਪਲੱਬਧ ਕਰਵਾਵੇ ਅਤੇ ਹਾਂ ਇਹ ਹੋ ਸਕਦਾ ਕਿ ਕਈ ਹਸਪਤਾਲਾਂ ਵਿੱਚ ਵਧੀਆ ਹੁੰਦੇ ਹਨ ਅਤੇ ਕਈਆਂ ਵਿੱਚ ਨਹੀਂ